ਪੰਜਾਬੀ ਭਾਸ਼ਾ ਏਸ਼ੀਆ ਦੇ ਖਿੱਤੇ ਵਿੱਚ ਬਹੁਤ ਸਾਰੇ ਲੋਕ ਬੋਲਦੇ ਹਨ ਅਤੇ ਅਕਸਰ ਇਸਦੀ ਹਿੰਦੀ ਨਾਲ ਤੁਲਨਾ ਕੀਤੀ ਜਾਂਦੀ ਹੈ ਔਰ ਬਹੁਤ ਸਾਰੇ ਸ਼ਬਦ ਪੰਜਾਬੀ ਦੇ ਹਿੰਦੀ ਭਾਸ਼ਾ ਦੇ ਵਿੱਚ ਜਾ ਚੁੱਕੇ ਨੇ ਇਸ ਤਰ੍ਹਾਂ ਹੀ ਹਿੰਦੀ ਭਾਸ਼ਾ ਦੇ ਬਹੁਤ ਸਾਰੇ ਸ਼ਬਦ ਪੰਜਾਬੀ ਭਾਸ਼ਾ ਵਿੱਚ ਸੰਮਿਲਤ ਹੋਏ ਨੇ ਪਰੰਤੂ ਪੰਜਾਬੀ ਭਾਸ਼ਾ ਦੀ ਵਿਲੱਖਣਤਾ ਇਸ ਗੱਲ ਵਿੱਚ ਹੈ ਕਿ ਜਿੰਨੇ ਵੀ ਲੋਕ ਬਾਹਰਲੇ ਮੁਲਕਾਂ ਤੋਂ ਪੁਰਾਤਨ ਸਮਿਆਂ ਦੇ ਵਿੱਚ ਆਏ ਭਾਰਤੀ ਉਪ ਮਹਾਂਦੀਪ ਵੱਲ ਤਾਂ ਉਹ ਪੰਜਾਬ ਦੇ ਰਾਹੀਂ ਹੋ ਕੇ ਆਏ ਅਤੇ ਇਸ ਤਰ੍ਹਾਂ ਆਪਣੀ ਭਾਸ਼ਾਵਾਂ ਵੀ ਨਾਲ ਲੈ ਕੇ ਆਏ ਅਤੇ ਉਹਨਾਂ ਦੇ ਬਹੁਤ ਸਾਰੇ ਸ਼ਬਦ ਚਾਹੇ ਉਹ ਫਾਰਸੀ ਦੇ ਹੋਣ ਅੰਗਰੇਜ਼ੀ ਦੇ ਹੋਣ ਜਾਂ ਹੋਰ ਵੱਖ ਵੱਖ ਭਾਸ਼ਾਵਾਂ ਦੇ ਹੋਣ ਉਹਦੇ ਵਿੱਚ ਸਹਿਜੇ ਹੀ ਸ਼ਾਮਿਲ ਹੋ ਗਏ ਅਤੇ ਇਸ ਤਰ੍ਹਾਂ ਪੰਜਾਬੀ ਭਾ ਭਾਸ਼ਾ ਜੋ ਹੈ ਬਹੁਤ ਹੀ ਅਮੀਰ ਵਿਰਾਸਤ ਨਾਲ ਭਰਪੂਰ ਹੈ ਅਤੇ ਇਹਦਾ ਇੱਕ ਵੱਖਰਾ ਹੀ ਜੋ ਇੱਕ ਰੁਤਬਾ ਹੈ ਦੁਨੀਆ ਦੀ ਭਾਸ਼ਾਵਾਂ ਦੇ ਵਿੱਚ ਅਤੇ ਹੋਰ ਭਾਸ਼ਾਵਾਂ ਨਾਲੋਂ ਵੱਖਰੀ ਹੁੰਦਿਆਂ ਹੋਇਆਂ ਵੀ ਇਹ ਬਹੁਤ ਸਾਰੇ ਦੇਸ਼ਾਂ ਦੇ ਵੱਖ ਵੱਖ ਲੋਕਾਂ ਦੁਆਰਾ ਪਸੰਦ ਕੀਤੀ ਜਾਂਦੀ ਹੈ ਖਾਸ ਤੌਰ 'ਤੇ ਇਸ ਦੇ ਗੀਤ ਜੋ ਗਾਇਕਾਂ ਦੁਆਰਾ ਗਾਏ ਜਾਂਦੇ ਹਨ ਅੰਤਰਰਾਸ਼ਟਰੀ ਪੱਧਰ ਦੇ ਹਨ